ਹੈਲੋ ਮੈਂ ਗੁਰਦਾਸਪੁਰ ਤੋਂ ਜਗਦੀਸ਼ ਕੁਮਾਰੀ ਬੋਲ ਰਹੀ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਇਸ ਸਮੇਂ ਖੇਤੀ ਉਦਯੋਗ ਦੇ ਸਾਹਮਣੇ ਪਾਣੀ ਮਿੱਟੀ ਵਿੱਚ ਪੌਸ਼ਟਿਕ ਤੱਤ ਨਾ ਹੋਣ ਦੀ ਸਮੱਸਿਆ ਅਤੇ ਮੌਸਮ ਦੀ ਇੱਕ ਪ੍ਰਮੁੱਖ ਕਾਰਨ ਹੈ ਜਿਸ ਵਿੱਚ ਕਿਸਾਨ ਫਸਲ ਉਗਾਉਂਦਾ ਹੈ ਅਤੇ ਕਈ ਵਾਰੀ ਪਾਣੀ ਦੀ ਸਮੱਸਿਆ ਵੀ ਹੋ ਜਾਂਦੀ ਹੈ ਗਰਮੀ ਗਰਮੀ ਕਰਕੇ ਫਸਲ ਜਿਹੜੀ ਖਰਾਬ ਹੋ ਜਾਂਦੀ ਹੈ ਸਰਦੀਆਂ ਵਿੱਚ ਜਦੋਂ ਫਸਲ ਉਗਾਉਂਦੇ ਹਾਂ ਤਾਂ ਠੰਢ ਕਾਰਨ ਫਸਲ ਬਹੁਤ ਹੀ ਮੁਰਝਾ ਜਾਂਦੀ ਹੈ ਤਾਂ ਕਿ ਫ ਫਸਲ ਨੂੰ ਪੂਰਾ ਤੱਤ ਨਹੀਂ ਮਿਲਦਾ ਇਸ ਕਰਕੇ ਫਸਲ ਖਰਾਬ ਹੋ ਜਾਂਦੀ ਹੈ ਅਤੇ ਬਹੁਤ ਸਾਰੀਆਂ ਖਾਦਾਂ ਅੱਜ ਕੱਲ੍ਹ ਬਹੁਤ ਮਾੜੀਆਂ ਆ ਰਹੀਆਂ ਹਨ ਜਿਹਨਾਂ ਕਰਕੇ ਫਸਲ ਉਹ ਜ਼ਿਆਦਾ ਖਰਾਬ ਹੋ ਜਾਂਦੀ ਹੈ ਇਸ ਕਰਕੇ ਕਿਸਾਨ ਜਿਹੜੀ ਫਸਲ ਉਗਾਉਂਦਾ ਹੈ ਅਤੇ ਫਸਲ ਦਾ ਤੱਤ ਬਹੁਤ ਹੀ ਖਰਾਬ ਹੋ ਜਾਂਦਾ ਹੈ ਸਾਨੂੰ ਵਧੀਆ ਖਾਦ ਵਰਤਣੀ ਚਾਹੀਦੀ ਹੈ ਬਦਲ ਬਦਲ ਕੇ ਖਾਦਾਂ ਵਰਤਣੀਆਂ ਚਾਹੀਦੀਆਂ ਹਨ ਕਈ ਵਾਰੀ ਅਸੀਂ ਜਦੋਂ ਫਸਲ ਉਗਾਉਂਦੇ ਹਾਂ ਤਾਂ ਵਾਰ ਵਾਰ ਇੱਕ ਫਸਲ ਉਗਾਉਣ ਕਰਕੇ ਮਿੱਟੀ ਵੀ ਖਰਾਬ ਹੋ ਜਾਂਦੀ ਹੈ ਅਤੇ ਪਾਣੀ ਦਾ ਬਹੁਤ ਹੀ ਮਹੱਤਵ ਹੈ ਜਿਹੜਾ ਕਿ ਪਾਣੀ ਵੀ ਅੱਜ ਕੱਲ੍ਹ ਬਹੁਤ ਖਰਾਬ ਆ ਰਿਹਾ ਹੈ ਜਿਹਦੇ ਨਾਲ ਫਸਲ ਜਿਹੜੀ ਹੈ ਉਹ ਖਰਾਬ ਹੋ ਜਾਂਦੀ ਹੈ ਇਸ ਕਰਕੇ ਮਿੱਟੀ ਵੀ ਜ਼ਰੂਰ ਮਿੱਟੀ ਵੀ ਖਰਾਬ ਹੋ ਜਾਂਦੀ ਹੈ ਮਿੱਟੀ ਦੇ ਵਿੱਚ ਤੱਤ ਜਿਹੜੇ ਹਨ ਉਹ ਬਹੁਤ ਹੀ ਖਰਾਬ ਹੋ ਜਾਂਦੇ ਹਨ ਇਸ ਕਰਕੇ ਕਿਸਾਨ ਫਸਲ ਦੀ ਦੇਖਭਾਲ ਵਧੀਆ ਕਰਦਾ ਹੈ ਪਰ ਮੀਂਹ ਕਰਕੇ ਫਸਲ ਕਈ ਵਾਰੀ ਖਰਾਬ ਹੋ ਜਾਂਦੀ ਹੈ